ਦੇਖੋ ਜੇ ਪੰਜਾਬ ਦੇ ਪਿੰਡਾਂ ਦੀ ਗੱਲ ਕਰੀ ਜਾਵੇ ਤਾਂ ਪਿੰਡ ਡਿਵਲਪਟ ਤਾਂ ਹੋਏ ਹੈ ਇੱਦਾਂ ਦੀ ਗੱਲ ਨਹੀਂ ਕਿ ਡਿਵਲਪ ਨਹੀਂ ਹੋਏ ਸ਼ਹਿਰੀਕਰਨ ਦਾ ਪ੍ਰਭਾਵ ਪੰਜਾਬ ਦੇ ਪਿੰਡਾਂ ਦੀ ਵਿੱਚ ਪਿਆ ਹੈ ਜੇਕਰ ਆਪਾਂ ਬ ਗੱਲ ਕਰੀਏ ਫ਼ਸਲਾਂ ਦੀ ਜੇਕਰ ਆਪਾਂ ਗੱਲ ਕਰੀਏ ਬਿਜਲੀ ਪਾਣੀ ਦੀ ਤਾਂ ਸਾਰਾ ਕੁਛ ਹੁਣ ਹੌਲੀ ਹੌਲੀ ਕਰਕੇ ਪੰਜਾਬ ਦੇ ਪਿੰਡਾਂ ਵੱਲ ਆ ਰਿਹਾ ਹੈ ਅਤੇ ਸ਼ਹਿਰੀਕਰਨ ਮੰਨੋ ਇੰਨੀ ਵੱਡੀ ਬਿਲਡਿੰਗ ਆ ਡਿਵਲਪਮੈਂਟ ਰੋਡ ਤਾਂ ਬਣੇ ਹੈ ਪਰ ਉਨੀ ਡਿਵਲਪਮੈਂਟ ਜੇਕਰ ਆਪਾਂ ਕਹੀਏ ਕਿ ਪੰਜਾਬ ਦਾ ਖੁਦ ਦਾ ਕਲਚਰ ਖ਼ਤਮ ਹੋਣ 'ਤੇ ਆਇਆ ਅਤੇ ਉਹ ਚੀਜ਼ ਪੰਜਾਬ ਦੇ ਪਿੰਡਾਂ ਵਿੱਚ ਹਲੇ ਨਹੀਂ ਹੋਈ ਹਜੇ ਵੀ ਪੰਜਾਬ ਦੇ ਪਿੰਡਾਂ ਵਿੱਚ ਉਹਨਾਂ ਦਾ ਪੁਰਾਣਾ ਜਿਹੜਾ ਕਲਚਰ ਹੈ ਉਹ ਹਜੇ ਵੀ ਉਹ ਬਚਾ ਕੇ ਰੱਖਿਆ ਹੋਇਆ ਪੰਜਾਬੀ ਲੋਕਾਂ ਨੇ ਅਤੇ ਜੇਕਰ ਆਪਾਂ ਗੱਲ ਕਰੀਏ ਆਪਣੇ ਬਠਿੰਡੇ ਦੇ ਪਿੰਡਾਂ ਦੀ ਬਠਿੰਡੇ ਦੇ ਪਿੰਡ ਇੱਦਾਂ ਦੇ ਹੈਗੇ ਹੈ ਕਿ ਉੱਥੇ ਡਿਵਲਪਮੈਂਟ ਤਾਂ ਹੋਈ ਹੈ ਯੂਨੀਵਰਸਿਟੀਆਂ ਆਈਆਂ ਨੇ ਪਿੰਡਾਂ ਦੇ ਵੱਲ ਪਰ ਉਨਾ ਡਿਵਲਪਮੈਂਟ ਜੇਕਰ ਤੁਸੀਂ ਮੰਨੋ ਬਿਲਡਿੰਗਾਂ ਬਣੀਆਂ ਅਤੇ ਉਹ ਚੀਜ਼ ਡਿਵਲਪਮੈਂਟ ਨਹੀਂ ਹੋਈ ਅਤੇ ਮੈਂ ਹੁਣ ਗੱਲ ਕਰਾਂ ਜੇਕਰ ਮੈਂ ਰਹਿਣਾ ਪਸੰਦ ਕਰਾ ਤਾਂ ਮੈਂ ਆਪਣੀ ਜੜ੍ਹ ਦੇ ਮਿੱਟੀ ਦੇ ਨਾਲ ਜੁੜ ਕੇ ਰਹਿਣਾ ਪਸੰਦ ਕਰੂੰਗਾ ਮੈਂ ਪਿੰਡਾਂ ਵਿੱਚ ਰਹਿਣਾ ਪਸੰਦ ਕਰੂੰਗਾ ਕਿਉਂ ਕਿਉਂਕਿ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜੇਕਰ ਆਪਾਂ ਦੇਖੀਏ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਆਪਣਾ ਕਿ ਆਪਾਂ ਡਿਵਲਪ ਕਰੀਏ ਆਪਣੇ ਪਿੰਡਾਂ ਨੂੰ ਵੀ ਪਿਛੋਕੜ ਤੋਂ ਲੈ ਕੇ ਆਪਾਂ ਅੱਗੇ ਆਈਏ ਪਿੰਡਾਂ ਨੂੰ ਡਿਵਲਪ ਕਰੀਏ ਅਤੇ ਪਿੰਡਾਂ ਦੇ ਵਿੱਚ ਜਿੰਨਾ ਹੋ ਸਕੇ ਆਪਾਂ ਪੋਜੀਟਿਵ ਅੱਛੀ ਚੀਜ਼ਾਂ ਲੈ ਕੇ ਆਈਏ ਜੇਕਰ ਆਪਾਂ ਪੜ੍ਹਾਈ ਦੀ ਵੀ ਗੱਲ ਕਰਦੇ ਹਾਂ ਤਾਂ ਵੱਡੀ ਵੱਡੀ ਯੂਨੀਵਰਸਿਟੀਆਂ ਹੁਣ ਆਪਣੇ ਪਿਛੋਕੜ ਏਰੀਏ ਵਿੱਚ ਅਤੇ ਪਿੰਡਾਂ ਦੇ ਵਿੱਚ ਡਿਵਲਪ ਹੋ ਰਹੀਆਂ ਨੇ ਅਤੇ ਰੋਡ ਵੀ ਇਨੀਸ਼ੀਏਟ ਡਿਵਲਪ ਹੋ ਰਹੇ ਨੇ ਅਤੇ ਜੇ ਜੇਕਰ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਹਾਂ ਪੰਜਾਬ ਦਾ ਪੰਜਾਬ ਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਉੱਤੇ ਸ਼ਹਿਰੀਕਰਨ ਦਾ ਇੱਕ ਬਹੁਤ ਅੱਛਾ ਪ੍ਰਭਾਵ ਪੈ ਰਿਹਾ ਹੈ